ਸਾਡੇ ਪੰਜਾਬੀ ਸੱਭਿਆਚਾਰ ਵਿੱਚ ਵਿਆਹ ਦੀ ਰਸਮ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਸਭ ਤੋ ਪਹਿਲਾਂ ਲੇਡੀ ਸੰਗੀਤ ਦੀ ਰਸਮ ਕੀਤੀ ਜਾਂਦੀ ਹੈ ਉਸਦੇ ਵਿੱਚ ਸਾਰੇ ਨਾਨਕੇ ਦਾਦਕੇ ਵਿਆਹ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਪੂਰਾ ਸਜ ਧਜ ਕੇ ਆਉਂਦੇ ਹਨ ਅਤੇ ਇਸ ਵਿੱਚ ਗਾਉਣ ਵਜਾਉਣ ਦਾ ਵੀ ਪ੍ਰੋਗਰਾਮ ਕੀਤਾ ਜਾਂਦਾ ਹੈ ਅਤੇ ਰਾਤ ਨੂੰ ਜਾਗੋ ਕੱਢੀ ਜਾਂਦੀ ਹੈ ਜਾਗੋ ਦੇ ਵਿੱਚ ਸਾਰਿਆਂ ਹੀ ਸਾਰਿਆਂ ਵੱਲੋਂ ਬਹੁਤ ਖੁਸ਼ੀ ਮਨਾਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਰਾਤ ਨੂੰ ਹੀ ਮਹਿੰਦੀ ਦਾ ਮਹਿੰਦੀ ਦੀ ਰਸਮ ਵੀ ਕੀਤੀ ਜਾਂਦੀ ਹੈ ਇਸਦੇ ਵਿੱਚ ਸਾਰੀਆਂ ਭੈਣਾਂ ਭਰਜਾਈਆਂ ਸ਼ਾਮਿਲ ਹੋ ਕੇ ਵਿਆਹ ਵਾਲੀ ਕੁੜੀ ਨੂੰ ਮਹਿੰਦੀ ਲਗਾਉਂਦੀਆਂ ਉਸ ਤੋਂ ਬਾਅਦ ਵਟਣਾ ਮਲਿਆ ਜਾਂਦਾ ਹੈ ਜੋ ਕਿ ਇਕ ਬਹੁਤ ਹੀ ਪੁਰਾਣਾ ਪੁਰਾਣੀ ਰਸਮ ਹੈ ਅਤੇ ਇਸ ਦੇ ਨਾਲ ਸਾਰੇ ਰਿਸ਼ਤੇਦਾਰ ਕੁੜੀ ਦੇ ਮਾਮੇ ਮਾਮੀਆਂ ਤਾਈਆਂ ਚਾਚੀਆਂ ਸਾਰੇ ਵਟਣਾ ਮਲਦੇ ਹਨ ਇਹ ਵੀ ਇੱਕ ਪੁਰਾਣੀ ਰਸਮ ਹੈ ਅਗਲੇ ਦਿਨ ਸਿਹਰਾਬੰਦੀ ਦਾ ਦੀ ਰਸਮ ਕੀਤੀ ਜਾਂਦੀ ਇਸਦੇ ਵਿੱਚ ਭੈਣਾਂ ਆਪਣੇ ਭਰਾਵਾਂ ਦੇ ਸਿਹਰਾ ਬੰਨ੍ਹਦੀਆਂ ਅਤੇ ਉਸ ਤੋਂ ਬਾਅਦ ਭਰਜਾਈਆਂ ਸੁਰਮੇ ਦੀ ਰਸਮ ਪੂਰੀ ਕਰਦੀਆਂ ਹਨ ਇਹ ਰਸਮ ਕੇਵਲ ਭਰਜਾਈਆਂ ਵੱਲੋਂ ਹੀ ਕੀਤੀ ਜਾਂਦੀ ਹੈ ਅਤੇ ਵਿਆਹ ਵਾਲੇ ਮੁੰਡੇ ਨੂੰ ਘੋੜੀ 'ਤੇ ਚੜ੍ਹਾਇਆ ਜਾਂਦਾ ਹੈ ਅਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਉਸ ਤੋਂ ਬਾਅਦ ਉਸ ਤੋਂ ਬਾਅਦ ਆਨੰਦ ਕਾਰਜਾਂ ਦੇ ਲਈ ਲਿਜਾਇਆ ਜਾਂਦਾ ਹੈ ਜਿਹੜੀ ਕਿ ਇਹ ਪੁਰਾਣੀ ਰਸਮ ਹੈ ਅਤੇ ਵਿਆਹ ਚਾਰ ਲਾਵਾਂ ਦੇ ਦੁਆਰਾ ਹੀ ਸੰਪੂਰਨ ਹੁੰਦਾ ਹੈ ਅਤੇ ਇਸ ਦੇ ਵਿੱਚ ਸਾਰੇ ਗੁਰਦੁਆਰਾ ਸਾਹਿਬ ਪਹੁੰਚ ਕੇ ਆਨੰਦ ਕਾਰਜ ਦੀ ਰਸਮ ਨੂੰ ਪੂਰਾ ਕਰਦੇ ਹਨ ਅਤੇ ਇਸ ਵਿੱਚ ਵਿਆਹ ਵਾਲੇ ਮੁੰਡੇ ਅਤੇ ਕੁੜੀ ਨੂੰ ਉਹਨਾਂ ਦੇ ਮਾਤਾ ਪਿਤਾ ਵੱਲੋਂ ਆਨੰਜ ਆਨੰਦ ਕਾਰਜਾਂ ਦੀ ਰਸਮ ਨੂੰ ਪੂਰਾ ਕਰਵਾਇਆ ਜਾਂਦਾ ਹੈ ਅਤੇ ਇਸਦੇ ਵਿੱਚ ਕੁੜੀ ਦੇ ਪਿਤਾ ਮੁੰਡੇ ਨੂੰ ਪੱਲਾ ਫੜਾਉਂਦੇ ਹਨ ਅਤੇ ਉਸ ਤੋਂ ਬਾਅਦ ਚਾਰ ਲਾਵਾਂ ਲਈਆਂ ਜਾਂਦੀਆਂ ਹਨ ਅਤੇ ਲਾਵਾਂ ਦੀ ਰਸਮ ਪੂਰੀ ਹੋਣ ਤੋਂ ਬਾਅਦ ਸ਼ਾਮ ਨੂੰ ਸ਼ਾਮ ਤੱਕ ਵਿਆਹ ਵਾਲਾ ਵਿਆਹ ਵਾਲੀ ਜੋੜੀ ਘਰ ਪਹੁੰਚਣ ਤੋਂ ਬਾਅਦ ਮਾਵਾਂ ਪਾਣੀ ਵਾਰਨ ਦੀ ਰਸਮ ਪੂਰੀ ਕਰਦੀਆਂ ਹਨ ਅਤੇ ਉਸ ਤੋਂ ਬਾਅਦ ਕੰਗਣਾ ਖੇਡਿਆ ਜਾਂਦਾ ਹੈ ਅਤੇ ਇਹ ਵੀ ਰਸਮ ਪੁਰਾਣੀ ਹੈ ਤੇ ਇਸ ਵਿੱਚ ਵੀ ਸਾਰੇ ਵਧੀਆ ਆਨੰਦ ਉਠਾਉਂਦੇ ਹਨ ਉਸ ਤੋਂ ਬਾਅਦ ਕਈ ਘਰਾਂ ਵਿੱਚ ਤਾਂ ਹੁਣ ਅਗਲੇ ਦਿਨ ਵੀ ਵਿਆਹ ਦੀ ਪਾਰਟੀ ਰੱਖੀ ਜਾਂਦੀ ਹੈ ਜਿਸ ਵਿੱਚ ਕਿ ਸਾਰੇ ਰਿਸ਼ਤੇਦਾਰ ਸੱਦੇ ਜਾਂਦੇ ਹਨ ਅਤੇ ਵਿਆਹ ਦੀ ਰਸਮ ਨੂੰ ਪੂਰਾ ਕੀਤਾ ਜਾਂਦਾ ਹੈ ਅਤੇ ਸਾਰੇ ਰਿਸ਼ਤੇਦਾਰ ਇਸ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਵਿਆਹੀ ਹੋਈ ਜੋੜੀ ਨੂੰ ਆਸ਼ੀਰਵਾਦ ਦਿੰਦੇ ਹਨ ਅਤੇ ਸਾਰਿਆਂ ਵੱਲੋਂ ਭੰਗੜੇ ਪਾਏ ਜਾਂਦੇ ਹਨ ਖੁਸ਼ੀ ਦਾ ਮੌਕਾ ਹੁੰਦਾ ਹੈ ਅਤੇ ਪੰਜਾਬੀ ਵਿਆਹ ਬਹੁਤ ਵਧੀਆ ਲੱਗਦੇ ਹਨ